ਮੈਂ ਰਾਤੀ ਏ ਪੀ ਜੇ ਨਿਊਜ ਡੀ ਐਨ ਐਸ ਚੈਨਲ 'ਤੇ ਨੌ ਵਜੇ ਆਪਣੇ ਪਰਿਵਾਰ ਨਾਲ ਬੈਠ ਕੇ ਖਬਰਾਂ ਦੇਖਦੀ ਹਾਂ ਜਿਸ ਵਿੱਚ ਅੱਜ ਕੱਲ੍ਹ ਡਿਬੇਟ ਹੀ ਚੱਲਦੀ ਪਈ ਹੈ ਜੋ ਕਿ ਅੱਜ ਕੱਲ੍ਹ ਚੱਲ ਹੀ ਇਲੈਕਸ਼ਨਾਂ ਦਾ ਦੌ ਦੌਰ ਰਿਹਾ ਹੈ ਤਾਂ ਕਰਕੇ ਉਸ ਵਿੱਚ ਸਾਰੇ ਡਿਬੇਟ ਹੀ ਕਰਦੇ ਹੁੰਦੇ ਕਿ ਇਸਨੂੰ ਜਿਤਾਓ ਇਸਨੂੰ ਜਿਤਾਓ ਇਹ ਇਸ ਲਾਇਕ ਆ ਇਹ ਤਾਂ ਜਿੱਤਣਾ ਚਾਹੀਦਾ ਵਾ ਮਤਲਬ ਇਹ ਰੀਜ਼ਨ ਦਿੰਦੇ ਹੁੰਦੇ ਆ ਔਰ ਐਨੀ ਜ਼ਿਆਦਾ ਵੱਧ ਜਾਂਦੀ ਹੈ ਇਹਨਾਂ ਦੀ ਡਿਬੇਟ ਕਿ ਮਤਲਬ ਉਹਨਾਂ ਨੂੰ ਆਪਣਾ ਰਿਕਾਰਡਿੰਗ ਚੈਨਲ ਔਰ ਵੋਇਸ ਕੱਟ ਕਰਨੀ ਪੈਂਦੀ ਹੈ ਉਹ ਇੰਨਾ ਹਾਈ ਲੈਵਲ 'ਤੇ ਡਿਬੇਟ ਕਰਦੇ ਹੁੰਦੇ ਹਨ ਅਤੇ ਮੇਰੇ ਲਈ ਸੁਦੀਰ ਚੌਧਰੀ ਮੇਰਾ ਮਨਪਸੰਦ ਐਂਕਰ ਦਾ ਹੈ ਜੋ ਕਿ ਬਹੁਤ ਵਧੀਆ ਮਤਲਬ ਡਿਬੇਟ ਕਰਦਾ ਹੈ ਬੋਲਦਾ ਹੈ ਔਰ ਜੋ ਬੋਲਦਾ ਉਹ ਸੱਚ ਹੀ ਬੋਲਦਾ ਹੈ